ਇਹ ਇੱਕ ਬਹੁਤ ਵਧੀਆ ਪ੍ਰਸ਼ਨ ਹੈ ਕਿ ਚਿਹਰੇ ਦੇ ਹਾਵ ਭਾਵ ਕਿਵੇਂ ਵਰਤੇ ਜਾਂਦੇ ਨੇ ਗਾਉਣ ਵੇਲੇ ਜਾਂ ਪ੍ਰਦਰਸ਼ਨ ਨੂੰ ਵਧਾਉਣ ਵੇਲੇ ਇਹਦੇ ਵਿੱਚ ਦੋ ਪਹਿਲੂ ਨੇ ਕਿ ਜਿਹੜੇ ਉਸਤਾਦ ਜੀ ਕੋਲ ਪਹਿਲਾਂ ਮੈਂ ਸਿੱਖਿਆ ਸੀ ਉਹ ਕਹਿੰਦੇ ਵੀ ਜ਼ਿਆਦਾ ਹਾਵ ਭਾਵ ਨਹੀਂ ਬਣਾਈ ਦੇ ਇਹਦਾ ਮਤਲਬ ਤੁਹਾਨੂੰ ਗਾਉਣਾ ਨਹੀਂ ਆਉਂਦਾ ਜੇ ਤੁਸੀਂ ਮੂੰਹ ਬਣਾ ਕੇ ਸੁਰ ਕੱਢ ਰਹੇ ਹੋ ਗਲੇ 'ਚੋਂ ਤਾਂ ਮਤਲਬ ਤੁਹਾਡੇ ਸੁਰ ਵਸਿਆ ਨਹੀਂ ਹੈਗਾ ਉਹ ਕਹਿੰਦੇ ਵੀ ਜਿੰਨਾਂ ਤੁਸੀਂ ਸਹਿਜ ਨਾਲ ਗਾਓਗੇ ਮਤਲਬ ਉਨਾਂ ਕੁ ਵਧੀਆ ਗਾਇਆ ਜਾਵੇਗਾ ਜਾਂ ਆਪਾਂ ਇਹਦਾ ਉਲਟਾ ਕਹਿ ਲਈਏ ਜਿੰਨਾਂ ਕਿਸੇ ਨੇ ਪ੍ਰੈਕਟਿਸ ਕੀਤੀ ਹੋਵੇਗੀ ਨਾ ਜਿਹੜਾ ਜਿੰਨਾਂ ਕਿਸੇ ਨੇ ਆਪਣਾ ਜਿਹੜਾ ਹੁਨਰ ਆ ਨਿਖਾਰਿਆ ਹੋਵੇਗਾ ਉਹਨੂੰ ਉਨਾਂ ਇਹਦੀ ਲੋੜ ਨਹੀਂ ਪੈਂਦੀ ਹਾਵ ਭਾਵਾਂ ਦੀ ਉਹ ਹਾਵ ਭਾਵ ਉਹਦੇ ਗਲੇ ਤੋਂ ਹੀ ਪੈਦਾ ਹੋ ਜਾਂਦਾ ਅਤੇ ਮੈਂ ਦੇਖਿਆ ਵੀ ਆ ਕਿ ਜਿਹੜੇ ਮਹਾਨ ਗਾਇਕ ਵੇਲੇ ਜਿਵੇਂ ਮੁਹੰਮਦ ਰਫੀ ਹੋਏ ਨੇ ਉਹ ਆਪਣੇ ਉਸਦੇ ਫ ਚੀਜ਼ ਦੇ ਨਾਲ ਹੀ ਗਲੇ ਦੀ ਨਾਲ ਹੀ ਨਾ ਉਹ ਸਾਰਾ ਜਿਹੜਾ ਸੀ ਗਾਣ ਦੀ ਜੋ ਉਸ ਗੀਤ ਦੀ ਜੋ ਰਿਕੁਆਰਿਮੈਂਟ ਸੀ ਉਹਨੂੰ ਪੂਰੀ ਕਰ ਲੈਂਦੇ ਸੀ ਕਿ ਇਸ 'ਚ ਕੀ ਚਾਹੀਦਾ ਹਾਸਾ ਚਾਹੀਦਾ ਕਿ ਸੈਡ ਸੌਂਗ ਆ ਉਸ ਤਰ੍ਹਾਂ ਜਾਣੀ ਕਿ ਉਹਨਾਂ ਦੇ ਹਾਵ ਭਾਵ ਤੋਂ ਪਤਾ ਨਹੀਂ ਲੱਗਦਾ ਸੀ ਕਿ ਉਹ ਕੀ ਕਹਿ ਰਹੇ ਨੇ ਅਤੇ ਇਸ ਕਰਕੇ ਮੈਂ ਅਤੇ ਕੋਈ ਜ਼ਿਆਦਾ ਇਸਦੇ ਕੋਈ ਹਾਵ ਭਾਵ ਇਸ ਤਰ੍ਹਾਂ ਬਣਾਉਣ ਦੀ ਕੋਸ਼ਿਸ਼ ਨਹੀਂ ਕੀਤੀ ਕਦੇ ਬਾਕੀ ਮੈਨੂੰ ਪਤਾ ਨਹੀਂ ਕਿ ਆਉਂਦੇ ਹੋਣ ਇਹ ਵਿਸ਼ਾ ਦੇਖਣ ਵਾਲਾ ਕਿ ਅੱਗੇ ਰੱਖ ਕੇ ਹੈ ਨਾ ਵੀ ਕੈਮਰੇ ਜਾਂ ਮੂਵੀ ਬਣਾ ਕੇ ਕਿਉਂਕਿ ਮੈਂ ਇਸ ਤਰ੍ਹਾਂ ਕਦੇ ਗਾਇਆ ਨਹੀਂ ਹੈਗਾ ਲਾਈਵ ਕਿ ਆਪਣਾ ਮੂ ਇਸ ਤਰ੍ਹਾਂ ਮੂਵੀ ਕੋਈ ਵੀਡੀਓ ਰਿਕੋਡਿੰਗ ਕੀਤੀ ਹੋਵੇ ਅਤੇ ਬਾਕੀ ਦੇਖਣ ਦਾ ਹੈ ਇੱਕ